ਅੱਜ ਕੱਲ੍ਹ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਐਪਸ ਹਨ ਪੇਟੀਐਮ ਵੱਟਸਐਪ ਫੇਸਬੁੱਕ ਇੰਸਟਾਗ੍ਰਾਮ ਟਿੱਕਟੋਕ ਯੂਟਿਊਬ ਮਸੈਂਜਰ ਓਲਾ ਕੈਬਜ਼ ਮੀਸ਼ੋ ਜੋਮੈਟੋ ਸ਼ੇਅਰਇੱਟ ਲੂਡੋ ਕਿੰਗ ਟਰੂ ਕੋਲਰ ਵੀਚੈਟ ਯੂ ਸੀ ਬ੍ਰਾਊਜ਼ਰ ਸਨੈਪਚੈਟ ਅਤੇ ਗੂਗਲ ਇਹਨਾਂ ਵਿੱਚੋਂ ਵੱਟਸਐਪ ਹੈ ਜਿਹੜਾ ਉਹ ਇੱਕ ਦੂਜੇ ਨਾਲ਼ ਗੱਲ ਬਾਤ ਕਰਨ ਲਈ ਵਰਤਿਆ ਜਾਂਦਾ ਹੈ ਇਸ ਵਿੱਚ ਆਪਾਂ ਵੀਡਿਓ ਕੋਲ ਵੀ ਕਰ ਸਕਦੇ ਹਾਂ ਪੇਟੀਐਮ ਦੇ ਰਾਹੀਂ ਆਪਾਂ ਇੱਕ ਦੂਜੇ ਨੂੰ ਮਨੀ ਟ੍ਰਾਂਸਫਰ ਕਰ ਸਕਦੇ ਹਾਂ ਇਹ ਐਪ ਬਹੁਤ ਹੀ ਵਧੀਆ ਹੈ ਕਿਉਂਕਿ ਇਸ ਦੇ ਨਾਲ਼ ਆਪਾਂ ਘਰ ਬੈਠੇ ਹੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਪੈਸੇ ਟ੍ਰਾਂਸਫਰ ਕਰ ਸਕਦੇ ਹਾਂ ਫੇਸਬੁੱਕ ਦੇ ਨਾਲ਼ ਆਪਾਂ ਨੂੰ ਦੁਨੀਆਂ ਭਰ ਦੀ ਖ਼ਬਰਾਂ ਮਿਲਦੀਆਂ ਹਨ ਇੰਸਟਾਗ੍ਰਾਮ 'ਤੇ ਵੀ ਅਸੀਂ ਇੱਕ ਦੂਜੇ ਨਾਲ਼ ਜੁੜੇ ਰਹਿੰਦੇ ਹਾਂ ਯੂਟਿਊਬ ਉੱਤੇ ਆਪਾਂ ਨੂੰ ਹਰੇਕ ਤਰ੍ਹਾਂ ਦੀ ਨੌਲੇਜ ਮਿਲਦੀ ਹੈ ਚਾਹੇ ਕਿ ਉਹ ਕਿਸੇ ਚੀਜ਼ ਦੀ ਰੈਸਿਪੀ ਹੋਵੇ ਕਿਸੇ ਚੀਜ਼ ਦੀ ਕਲਾਸਿਜ਼ ਹੋਵੇ ਯੂਟਿਊਬ ਅਕਸਰ ਬੱਚਿਆਂ ਦੇ ਵੀ ਬਹੁਤ ਕੰਮ ਆਉਂਦੀ ਹੈ ਜਿਵੇਂ ਕਿ ਉਸ ਅਸੀਂ ਉਸ 'ਤੇ ਕਲਾਸਿਜ਼ ਲਗਾ ਸਕਦੇ ਹਾਂ ਅਗਰ ਸਾਨੂੰ ਕੋਈ ਵੀ ਡਾਊਟ ਹੁੰਦਾ ਹੈ ਤਾਂ ਅਸੀਂ ਯੂਟਿਊਬ ਦੀ ਵੀਡਿਓ ਦੇਖ ਕੇ ਉਸ ਨੂੰ ਸੋਲਵ ਕਰ ਸਕਦੇ ਹਾਂ ਓਲਾ ਕੈਬਜ਼ ਵੀ ਸਾਡੇ ਅੱਜ ਦੀ ਜੀਵਨ ਵਿੱਚ ਬਹੁਤ ਮਹੱਤਵਪੂਰਨ ਰੋਲ ਪੈਦਾ ਕਰ ਰਹੀਆਂ ਹਨ ਓਲਾ ਕੈਬਜ਼ ਦੇ ਰਾਹੀਂ ਅਸੀਂ ਕੈਬ ਬੁੱਕ ਕਰਾ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਆਸਾਨੀ ਨਾਲ਼ ਜਾ ਸਕਦੇ ਹਾਂ ਮੀਸ਼ੋ ਐਪ ਦੇ ਵਿੱਚ ਅਸੀਂ ਕੋਈ ਵੀ ਸਮਾਨ ਨੂੰ ਘੱਟ ਰੇਟ 'ਤੇ ਮੰਗਵਾ ਸਕਦੇ ਹਾਂ ਇਹ ਐਪ ਦੇ ਵਿੱਚ ਬਹੁਤ ਹੀ ਵਧੀਆ ਅਤੇ ਰੀਜ਼ਨੇਬਲ ਪ੍ਰਾਈਜ਼ 'ਤੇ ਸਾਨੂੰ ਸਮਾਨ ਮਿਲ ਜਾਂਦਾ ਹੈ ਜ਼ੋਮੈਟੋ ਦੇ ਰ ਵਿੱਚ ਅਸੀਂ ਖਾਣ ਪੀਣ ਦੀ ਕੋਈ ਵੀ ਚੀਜ਼ ਮੰਗਵਾ ਸਕਦੇ ਹਾਂ ਅਸੀਂ ਜੋਮੈਟੋ ਦੇ ਵਿੱਚ ਕਿਸੇ ਵੀ ਟਾਈਮ ਆਪਣੇ ਘਰ ਦੇ ਵਿੱਚ ਕੋਈ ਵੀ ਚੀਜ਼ ਨੂੰ ਔਡਰ ਕਰਵਾ ਸਕਦੇ ਹਾਂ ਸ਼ੇਅਰਇੱਟ